ਹਾਂਜੀ ਮੈਂ ਚੰਡੀਗੜ੍ਹ ਜੂ ਦੇ ਵਿੱਚ ਪੰਛੀ ਤਾਂ ਬਹੁਤ ਤਰ੍ਹਾਂ ਦੇ ਦੇਖੇ ਆ ਜਾਂ ਪਟਿਆਲੇ ਛੱਤਵੀੜ ਵਿੱਚ ਜੀ ਪਰ ਮੈਂ ਉਹਨਾਂ ਨਾਲ ਕਦੇ ਪੰਛੀਆਂ ਨਾਲ ਕੋਈ ਖਾਸ ਮੁਲਾਕਾਤ ਨਹੀਂ ਕੀਤੀ ਦੂਰ ਤੋਂ ਤਾਂ ਮੈਂ ਬਹੁਤ ਵਾਰੀ ਪੰਛੀਆਂ ਨੂੰ ਤੱਕਿਆ ਹੈ ਉਹ ਉੜਦੇ ਤੇ ਚਹਿਕਦੇ ਬਹੁਤ ਹੀ ਪਿਆਰੇ ਲੱਗਦੇ ਹਨ ਪਰ ਜਦੋਂ ਕੋਈ ਆਪਾਂ ਖੇਤ ਵਿੱਚ ਇਦਾਂ ਦਾ ਕੋਈ ਮੈਂ ਦੁਰਲੱਭ ਪਾਛੀ ਤਾਂ ਨਹੀਂ ਕਦੇ ਦੇਖਿਆ ਜੀ ਮੈਂ ਤਾਂ ਜੀ ਦੇਖਿਆ ਤਾਂ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਮੋਰ ਬਹੁਤ ਜ਼ਿਆਦਾ ਹੁੰਦੇ ਨੇ ਜੋ ਕਿ ਆਪਾਂ ਨੂੰ ਬਹੁਤ ਹੀ ਪਿਆਰੇ ਤੇ ਬਹੁਤ ਹੀ ਸੋਹਣੇ ਲੱਗਦੇ ਹਨ ਜੀ